ਸਾਡੇ ਪੰਜਾਬ ਵਿੱਚ ਇੱਕ ਬਠਿੰਡਾ ਸ਼ਹਿਰ ਹੈ ਜੋ ਕਿ ਵਧੀਆ ਇਲਾਕਾ ਹੈ ਬਠਿੰਡਾ ਵਿਖੇ ਬਹੁਤ ਹੀ ਮਹੱਤਵਪੂਰਨ ਇੱਕ ਗੁਰਦੁਆਰਾ ਅਸਥਾਨ ਹੈ ਜੋ ਕਿ ਕਿਲ੍ਹਾ ਸਾਹਿਬ ਅਤੇ ਹਜੀ ਰਤਨ ਸਾਹਿਬ ਹਨ ਉੱਥੋਂ ਦਾ ਮਹਾਨ ਇਤਿਹਾਸਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇੱਥੋਂ ਦੇ ਸੈਰ ਸਪਾਟੇ ਲਈ ਸਾਨੂੰ ਝੀਲਾਂ ਵੀ ਦੇਖਣ ਨੂੰ ਮਿਲਦੀਆਂ ਹਨ ਅਤੇ ਥਰਮਲ ਵੀ ਦੇਖਣ ਨੂੰ ਮਿਲਦੇ ਹਨ ਅਤੇ ਖਾਣ ਪੀਣ ਨੂੰ ਵੀ ਬਹੁਤ ਵਧੀਆ ਹਨ ਅਤੇ ਘੁੰਮਣ ਫਿਰਨ ਨੂੰ ਵੀ ਬਹੁਤ ਵਧੀਆ ਸ਼ਹਿਰ ਹੈ ਅਤੇ ਇਤਿਹਾਸਿਕ ਚੀਜ਼ ਵੀ ਹੈ ਉਦਾਹਰਨ ਤੌਰ 'ਤੇ ਜਿਵੇਂ ਕਿ ਕਿਲ੍ਹਾ ਸਾਹਿਬ ਗੁਰਦੁਆਰਾ ਵੀ ਹੈ ਅਤੇ ਅੰਮ੍ਰਿਤਸਰ ਸ਼ਹਿਰ ਵਿਖੇ ਹਰਿਮੰਦਰ ਸਾਹਿਬ ਇੱਕ ਗੁਰਦੁਆਰਾ ਜੋ ਕਿ ਹਿਸਟਰੀ ਵਿੱਚ ਵੀ ਇਸ ਘਟਨਾ ਦਾ ਜ਼ਰੀਆ ਦੇਖਣ ਨੂੰ ਮਿਲਦਾ ਹੈ ਜੋ ਕਿ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਨੂੰ ਵੀ ਪ੍ਰੇਰਿਤ ਕਰਦਾ ਹੈ ਇੱਥੋਂ ਦਾ ਖਾਣ ਪੀਣ ਨੂੰ ਜਿਵੇਂ ਕਿ ਅੰਮ੍ਰਿਤਸਰੀ ਕੁਲਚਾ ਅਤੇ ਅੰਮ੍ਰਿਤਸਰ ਦੇ ਪਾਪੜ ਖਾਣ ਨੂੰ ਵੀ ਵਧੀਆ ਹੈ